ਜਿਹੜੇ ਆਪਣੇ ਬਿਜਨਸ ਸੈਕਟਰਸ ਹੁੰਦੇ ਆ ਆਪਣੇ ਹੋਰ ਇੰਡਸਟਰੀਸ ਨਾਲ ਜਾਂ ਹੋਰ ਸੈਕਟਰਸ ਨਾਲ ਲਿੰਕ ਹੁੰਦੇ ਆ ਇਹ ਜਿਹੜੇ ਬਿਜਨਸ ਅਤੇ ਇੰਡਸਟਰੀਜ ਇੱਕ ਦੂਜੇ ਤੋਂ ਬਿਨਾ ਨਹੀਂ ਚੱਲ ਸਕਦੇ ਕਿਉਂ ਨਹੀਂ ਚੱਲ ਸਕਦੇ ਕਿਉਂਕਿ ਬਿਜ਼ਨਸ ਹੈ ਜਿਹੜੇ ਇੰਡਸਟਰੀਜ ਨੂੰ ਬਹੁਤ ਤਰ੍ਹਾਂ ਦੀ ਹੈਲਪ ਦਿੰਦੇ ਆ ਜਿਵੇਂ ਇਨਵੈਸਟਮੈਂਟ ਸਭ ਤੋਂ ਵੱਡੀ ਹੈਲਪ ਤਾਂ ਉਹ ਪੈਸਾ ਲਾਉਂਦੇ ਆ ਪੈਸਾ ਵੀ ਪ੍ਰੋਵਾਈਡ ਕਰਦੇ ਆ ਉਹ ਤੇ ਤੇ ਉਹ ਆਪਦੇ ਬਿਜਨਸ ਵਿੱਚ ਸ਼ੇਅਰ ਵੀ ਦਿੰਦੇ ਆ ਸ਼ੇਅਰ ਮਾਰਕੀਟ ਵਿੱਚ ਜਿਵੇਂ ਆਪਦਾ ਸ਼ੇਅਰਸ ਵੇਚ ਦਿੰਦੇ ਆ ਤਾਂ ਆਪਾਂ ਇਨਵੈਸਟਮੈਂਟ ਕਰ ਸਕਦੇ ਹਾਂ ਉਵੇਂ ਉਹ ਇੰਡਸਟਰੀਜ ਆ ਜਿਹੜੀਆਂ ਚੀਜ਼ਾਂ ਬਣਾਉਂਦੇ ਆ ਮੈਨੀਫੈਕਚਰਿੰਗ ਕਰਦੀਆਂ ਕੋਈ ਵੀ ਰੋ ਮਟੀਰੀਅਲ ਬਣਾਉਂਦੀ ਹੈ ਕੋਈ ਫਾਈਨਲ ਗੁਡਸ ਬਣਾਉਂਦੀਆਂ ਉਹ ਜਿਹੜੇ ਬਿਜਨਸ ਆ ਉਹਨਾਂ ਤੋਂ ਚੀਜ਼ਾਂ ਖਰੀਦਦੇ ਆ ਅਤੇ ਅਗਾਂਹ ਉਹ ਬਿਜ਼ਨਸ ਆ ਜਿਹੜੇ ਉਹ ਚੀਜ਼ਾਂ ਨੂੰ ਆਪਾਂ ਨੂੰ ਕਸਟਮਰਸ ਤੱਕ ਪਹੁੰਚਾਉਂਦੇ ਆ ਠੀਕ ਹੈ ਅਤੇ ਆਪਣੇ ਜਿਹੜੇ ਮੇਨ ਆ ਇਕਨੋਮੀ ਈਕੋਨਮੀ ਵਿੱਚ ਵੀ ਤਿੰਨ ਸੈਕਟਰਸ ਹੁੰਦੇ ਪਬਲਿਕ ਪ੍ਰਾਈਵੇਟ ਅਤੇ ਟੈਰੀਸਰੀ ਪਬਲਿਕ ਹੁੰਦਾ ਜਿਹੜੇ ਗੌਰਮੈਂਟ ਵਾਲੇ ਹੁੰਦੇ ਗੌਰਮੈਂਟਸ ਨੇ ਚਲਾਈਆਂ ਹੁੰਦੀਆਂ ਕੰਪਨੀਜ ਅਤੇ ਪ੍ਰਾਈਵੇਟ ਹੁੰਦੇ ਜਿਹੜੇ ਬੰਦਿਆਂ ਦੇ ਆਪਦੇ ਸਟਾਰਟਅਪਸ ਵਗੈਰਾ ਹੁੰਦੇ ਆ ਐਂਟਰਪਨਿਓਰ ਹੁੰਦੇ ਆ ਜਿਹੜੇ ਅਤੇ ਜਿਹੜੀ ਟੈਰੀਸ਼ਰੀ ਸੈਕਟਰ ਆ ਉਹ ਆਪਣੇ ਹੋਸਪਿਟਲ ਸਕੂਲ ਸਿਨੇਮਾਜ ਇਹ ਸਾਰੇ ਇੰਟਰਟੇਨਮੈਂਟ ਰਿਲੇਟਡ ਇਹ ਜਿਹੜੇ ਆਪਾਂ ਨੂੰ ਸਰਵਿਸ ਪ੍ਰੋਵਾਈਡ ਕਰਦੇ ਲੋਇਰ ਵਗੈਰਾ ਹੋ ਗਏ ਟੈਰੀਸ਼ਰ ਸੈਕਟਰ ਵਿੱਚ ਆਉਂਦੇ ਆ ਹੁਣ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਇੰਟਰਲਿੰਕਡ ਹੁੰਦੀਆਂ ਵੀ ਇੱਕ ਦੂਜੇ ਤੋਂ ਬਿਨਾ ਇਹ ਨਹੀਂ ਚੱਲ ਸਕਦੀਆਂ ਵੀ ਉਹ ਕੋਲੈਬਰੇਸ਼ਨ ਵੀ ਕਰ ਲੈਂਦੇ ਇੱਕ ਦੂਜੇ ਨਾਲ ਜਿਵੇਂ ਇੱਕ ਦੂਜੇ ਦੇ ਯੂਨਿਟੀ ਕਰ ਲਈ ਜਾਂ ਜਿਵੇਂ ਕੋਈ ਮੰਨ ਲਓ ਇੰਡਸਟਰੀ ਹੈ ਜਾਂ ਕੋਈ ਸੈਕਟਰ ਜਾਂ ਕੋਈ ਵੀ ਮਤਲਬ ਬਿਜਨਸ ਆ ਛੋਟਾ ਮੋਟਾ ਉਹ ਡੁੱਬ ਰਿਹਾ ਹੈਗਾ ਮਤਲਬ ਉਹ ਉਹਨੂੰ ਲੋਸ ਹੀ ਹੋ ਰਿਹਾ ਤਾਂ ਵੱਡੇ ਬਿਜਨਸ ਕੀ ਆ ਉਹਦੇ ਨਾਲ ਮਤਲਬ ਲਿੰਕ ਕਰ ਲੈਂਦੇ ਆ ਉਹਨੂੰ ਕੰਪਨੀ ਨੂੰ ਖਰੀਦ ਲੈਂਦੇ ਛੋਟੀ ਕੰਪਨੀ ਨੂੰ ਜਿਹਨੂੰ ਲੋਸ ਹੋ ਰਿਹਾ ਵੀ ਹਾਂ ਅਸੀਂ ਤੁਹਾਡੀ ਕੰਪਨੀ ਖਰੀਦ ਲਈ ਆ ਅਤੇ ਉਹ ਇਹ ਇਸ ਵੇਅ ਨਾਲ ਕਿ ਉਹ ਵੱਡੇ ਲੋ ਜਿਹੜੇ ਬਿਜ਼ਨਸ ਵਾਲੇ ਆਪਦਾ ਬਿਜ਼ਨਸ ਵੀ ਐਕਸਟੈਂਡ ਕਰਦੇ ਹੁੰਦੇ ਆ ਹੋਰ ਜਿਹੜੇ ਵੱਡੇ ਬਿਜਨਸ ਹੁੰਦੇ ਆ ਉਹਨਾਂ ਕੋਲ ਜ਼ਿਆਦਾ ਇਨੋਵੇਟਿਵ ਤਰੀਕੇ ਹੁੰਦੇ ਆ ਜ਼ਿਆਦਾ ਇਨਵੇਟਿਵ ਨੈਟਵਰਕਸ ਹੁੰਦਾ ਜਿਹਦੇ ਨਾਲ ਕੀ ਆ ਉਹ ਬਹੁਤ ਵਧੀਆ ਹੈਲਪ ਕਰ ਸਕਦੇ ਆ ਵੀ ਇਹ ਇੱਕ ਜਿਹੜੇ ਬਿਜ਼ਨਸ ਤੇ ਆ ਜਿਹੜੇ ਇੰਡਸਟਰੀਜ ਆ ਇੱਕ ਦੂਜੇ ਦੀ ਬਹੁਤ ਹੈਲਪ ਕਰਦੇ ਤਾਂ ਕਿ ਉਹ ਗਰੋ ਕਰਨ